ਮੈਂ ਅਨਮੋਲ ਬੋਲਦਾ ਵੀਰੇ ਅਤੇ ਆਪਾਂ ਅੰਮ੍ਰਿਤਸਰ ਮਿਲੇ ਸੀ ਅਤੇ ਮੈਂ ਹਾਂ ਹਾਂ ਠੀਕ ਆ ਅਤੇ ਮੈਂ ਫੂਡ ਵਲੋਗਰ ਹਾਂ ਵੀਡੀਓ ਪਾਉਂਦਾ ਅਤੇ ਤੁਸੀਂ ਮੈਨੂੰ ਦੱਸ ਸਕਦੇ ਵੀ ਮੁਕਤਸਰ ਸਾਹਿਬ ਦੇ ਕਿਹੜੇ ਕਿਹੜੇ ਬੇਕਰੀ ਵਗੈਰਾ ਵੀ ਵਧੀਆ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ

ਅੱਛਾ ਜੀ

ਕਿਹੜੇ ਕਿਹੜੇੇ ਆਪਾਂ ਪ੍ਰ ਪੈਟੀਜ਼ ਕਿਹੜੀ ਕਿਹੜੀ ਹੁੰਦੀਆਂ ਕੁਆਲਿਟੀਜ਼ ਆਪਾਂ ਕਾਹਦੇ ਵਾਸਤੇ ਦੇ ਕਿਹੜੀਆਂ ਅੱਛਾ ਜੀ ਹਾਂਜੀ ਹਾਂਜੀ ਬੋਲੋ ਅੱਛਾ ਜੀ

ਅੱਛਾ ਅਤੇ ਪੇਸਟਰੀ ਆਪਾਂ ਲੈਣੀ ਹੋਵੇ ਤਾਂ ਫਿਰ ਕਿੰਨਾ ਕੁ ਆਪਾਂ ਕਿਹੜਾ ਜ਼ਿਆਦਾ ਮਸ਼ਹੂਰ ਹੈਗੇ ਆ ਆਪਾਂ ਉਹਨਾਂ ਤੋਂ ਪੇਸਟਰੀ ਅੱਛਾ ਕਿਹੜਾ ਅੱਛਾ ਅੱਛਾ ਹਾਂ ਬਾਕੀ ਲੋਕੇਸ਼ਨ ਲਾ ਲਵਾਂਗੇ ਹਾਂਜੀ ਠੀਕ ਆ ਬਸ ਜੀ ਆਪਾਂ ਕੋਈ ਨਹੀਂ ਆਪਾਂ ਜ਼ਰੂਰ ਆਪਾਂ ਮਿਲਾਂਗੇ ਆਪਾਂ ਮੁਕਤਸਰ ਹੀ ਬਸ ਆਪਾਂ ਮਿਲ ਨਾਲੇ ਆਪਾਂ ਰੈਂਟ 'ਤੇ ਲਿੱਤਾ ਹੋਇਆ ਮੈਂ ਨਵਾਂ ਹੀ ਸੀ ਅਤੇ ਹਾਂਜੀ

ਹਾਂਜੀ ਹਾਂਜੀ ਵੀਡੀਓ ਹਾਂਜੀ ਸ਼ੁਕਰੀਆ